ਹੋਰ ਵੀਰੇ ਕੀ ਹਾਲ ਚਾਲ ਹੈ ਲੰਮੇ ਸਫ਼ਰ ਦੀ ਜੇ ਗੱਲ ਕਰਦੇ ਹੋ ਤਾਂ ਲੰਮਾ ਸਫ਼ਰ ਨੂੰ ਤੈਅ ਕਰਨ ਵਾਸਤੇ ਤੁਹਾਨੂੰ ਆਪ ਦੀ ਬੋਡੀ ਨੂੰ ਕਦੇ ਵੀ ਡੀਹਾਈਡਰੇਟ ਨਹੀਂ ਹੋਣ ਦੇਣਾ ਚਾਹੀਦਾ ਹੈਗਾ ਜੇਕਰ ਤੁਹਾਡੀ ਬੋਡੀ ਡੀਹਾਈਡਰੇਟ ਹੋ ਗਈ ਬੋਡੀ 'ਚ ਪਾਣੀ ਦੀ ਕਮੀ ਹੋ ਗਈ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਤਾਂ ਕਦੇ ਵੀ ਤੁਸੀਂ ਲੰਮਾ ਸਫ਼ਰ ਅਸਾਨੀ ਨਾਲ ਤੈਅ ਨਹੀਂ ਕਰ ਸਕਦੇ ਹੈਗੇ ਮੈਂ ਵੀਰੇ ਇੱਕ ਦਿਨ ਵਿੱਚ ਚਾਰ ਤੋਂ ਪੰਜ ਸੌ ਕਿਲੋਮੀਟਰ ਬਾਈਕ 'ਤੇ ਤੈਅ ਕੀਤਾ ਅਤੇ ਮੈਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਈ ਨਾ ਕਦੇ ਪਿੱਠ ਦਾ ਦਰਦ ਨਾ ਕਦੇ ਮੋਢਿਆਂ ਦਾ ਦਰਦ ਕਦੇ ਵੀ ਦਰਦ ਮਹਿਸੂਸ ਨਹੀਂ ਹੋਇਆ ਉਹਦੇ ਵਾਸਤੇ ਜ਼ਰੂਰੀ ਹੈ ਪਾਣੀ ਜ਼ਿਆਦਾ ਪੀਓ ਅਤੇ ਕੋਸ਼ਿਸ਼ ਕਰੋ ਓਇਲੀ ਖਾਣੇ ਤੋਂ ਜਾਂ ਫਾਸਟ ਫੂਡ ਤੋਂ ਜਿੰਨਾਂ ਬਚ ਕੇ ਰਹੋਂਗੇ ਉਨਾਂ ਹੀ ਜ਼ਿਆਦਾ ਵਧੀਆ ਜੇਕਰ ਤੁਸੀਂ ਫਾਸਟ ਫੂਡ ਜਾਂ ਓਇਲੀ ਜ਼ਿਆਦਾ ਖਾਣਾ ਖਾਂਦੇ ਹੋ ਤਾਂ ਲੰਮਾ ਸਫ਼ਰ ਤੈਅ ਕਰਨਾ ਬਹੁਤ ਔਖਾ ਲੰਮਾ ਸਫ਼ਰ ਨੂੰ ਤੈਅ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਪਾਣੀ ਜ਼ਿਆਦਾ ਪੀਓ ਜਿੰਨਾਂ ਜ਼ਿਆਦਾ ਪਾਣੀ ਤੁਸੀਂ ਪੀਓਗੇ ਉਨਾਂ ਹੀ ਜ਼ਿਆਦਾ ਸਫ਼ਰ ਵਧੀਆ ਰਹਿੰਦਾ ਅਤੇ ਥਕਾਵਟ ਮਹਿਸੂਸ ਘੱਟ ਹੁੰਦੀ ਹੈ ਬਾਕੀ ਕੋਸ਼ਿਸ਼ ਕਰੋ ਨੋਰਮਲੀ ਖਾਣਾ ਖਾਓ ਬਹੁਤਾ ਪੇਟ ਭਰ ਕੇ ਨਾ ਖਾਣਾ ਖਾਓ ਜੋ ਪੇਟ ਭਰ ਕੇ ਵੀ ਖਾਂਦੇ ਹੋ ਤਾਂ ਵੀ ਮਹਿਸੂਸ ਲੰਮਾ ਸਫ਼ਰ ਤੈਅ ਕਰਨਾ ਔਖਾ ਹੋ ਜਾਂਦਾ ਕਿਉਂ ਉਹਦੇ ਨਾਲ ਥਕਾਵਟ ਸਟਰੈਸ ਜ਼ਿਆਦਾ ਹੁੰਦੀ ਹੈ ਅਤੇ ਫਿਰ ਮੁਸ਼ਕਿਲ ਹੋ ਜਾਂਦੀ ਹੈ ਨੋਰਮਲੀ ਖਾਣਾ ਖਾਓ ਪਾਣੀ ਜ਼ਿਆਦਾ ਪੀਓ ਤਾਂ ਬਹੁਤ ਵਧੀਆ ਜੇ ਜੇਕਰ ਜ਼ਿਆਦਾ ਥਕਾਵਟ ਮਹਿਸੂਸ ਹੋਵੇ ਤਾਂ ਥੋੜ੍ਹੀ ਬਹੁਤਾ ਰਿਲੈਕਸ ਕਰੋ ਅਤੇ ਖਾਣਾ ਖਾ ਕੇ ਅਤੇ ਤੁਰਦੇ ਬਣੋ ਸਭ ਤੋਂ ਵਧੀਆ ਧੰਨਵਾਦ